ਅਸਲ ਵਿੱਚ ਪੰਜਾਬੀ ਸੱਭਿਆਚਾਰ ਵਿੱਚ ਰੰਗੋਲੀ ਸੂਰਜ ਨੂੰ ਪਾਣੀ ਚੜ੍ਹਾਉਣਾ ਸਿੰਧੂਰ ਲਾਉਣਾ ਧਾਗਾ ਬੰਨ੍ਹਣਾ ਮੰਦਰ ਜਾਣਾ ਇਹ ਸਾਰਾ ਕੁਝ ਸੰਕੇਤਕ ਹੈ ਧਾਰਮਿਕ ਰੀਤਾਂ ਦੇ ਵਿੱਚ ਇਹ ਸਾਨੂੰ ਸਮਝਾਇਆ ਗਿਆ ਹੈ ਕਿ ਮਨ ਜਿਹੜਾ ਹੈ ਉਹਦੇ ਵਿੱਚ ਹੀ ਪਰਮਾਤਮਾ ਹੈ ਇਹ ਸਾਰੀਆਂ ਸ ਧਾਰਮਿਕ ਰੀਤਾਂ ਸਿਰਫ ਸੰਕੇਤ ਮਾਤਰ ਹਨ ਇਸ ਕਰਕੇ ਪੰਜਾਬੀ ਸੱਭਿਆਚਾਰ ਜਾਂ ਭਾਰਤੀ ਸੱਭਿਆਚਾਰ ਵਿੱਚ ਇਹ ਸਾਰੀਆਂ ਸੰਕੇਤਕ ਵਸਤੂਆਂ ਨੇ ਸਾਨੂੰ ਆਪਣੇ ਮਨ ਵਿੱਚੋਂ ਹੀ ਪਰਮਾਤਮਾ ਨੂੰ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ